ਪੰਜਾਬ ਦੇ ਇਤਿਹਾਸ ਵਿੱਚ ਮੁੱਖ ਪ੍ਰਾਪਤੀਆਂ ਅਤੇ ਮੀਲ ਪੱਥਰ ਇਨ੍ਹਾਂ ਨੂੰ ਗਿਣਨ ਲੱਗੀਏ ਤਾਂ ਨੰਬਰ ਨਾ ਮਿਲੇ ਮਤਲਬ ਇਹ ਅਣਗਿਣਤ ਹਨ ਜਿਵੇਂ ਅਸੀਂ ਗੱਲ ਕਰਦੇ ਹਾਂ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੀ ਇੱਥੋਂ ਦੇ ਬਣੇ ਰੇਲ ਕੋਚ ਹਿੰਦੂਸਤਾਨ ਦੇ ਵਿੱਚ ਜਿੰਨੀਆਂ ਵੀ ਰੇਲਾਂ ਚੱਲਦੀਆਂ ਨੇ ਸਭ ਦੇ ਵਿੱਚ ਲੱਗੇ ਹੋਏ ਹਨ ਕੀ ਸ਼ਾਨਦਾਰ ਤੋਂ ਸ਼ਾਨਦਾਰ ਜਾਂ ਕੀ ਇੱਕ ਆਮ ਜਿਹੜੀ ਰੇਲ ਹੁੰਦੀ ਹੈ ਉਨ੍ਹਾਂ 'ਚ ਸਾਰੇ ਕੋਚ ਇੱਥੋਂ ਹੀ ਬਣ ਕੇ ਜਾ ਰਹੇ ਨੇ ਜਲੰਧਰ ਦੇ ਵਿੱਚ ਸਾਰਾ ਸਪੋਰਟਸ ਦਾ ਜਿੰਨਾਂ ਵੀ ਸਮਾਨ ਮਿਲਦਾ ਹੈ ਉਹ ਇੱਥੇ ਬੜਾ ਰਿਸਨੇਬਲ ਰੇਟਸ 'ਤੇ ਮਿਲਦਾ ਹੈ ਸਾਈਕਲ ਇੰਡਸਟਰੀ ਵੀ ਜਿਹੜੀ ਹੈ ਜਲੰਧਰ ਦੀ ਉਹ ਬਹੁਤ ਮਸ਼ਹੂਰ ਹੈ ਇਸੇ ਤਰੀਕੇ ਲੁਧਿਆਣਾ ਦਾ ਜਿਹੜਾ ਹੌਜ਼ਰੀ ਇੰਡਸਟਰੀ ਹੈ ਉਹ ਵੀ ਪੂਰੇ ਭਾਰਤ ਵਿੱਚ ਮਸ਼ਹੂਰ ਹੈ ਇਹਨਾਂ ਤੋਂ ਸਵਾਏ ਜੇ ਅਸੀਂ ਗੱਲ ਕਰੀਏ ਤਾਂ ਲੁਧਿਆਣਾ ਨੂੰ ਤਾਂ ਕਿਹਾ ਹੀ ਇੰਡਸਟੀਰਅਲ ਹੱਬ ਜਾਂਦਾ ਉੱਥੋਂ ਦੇ ਇੰਡਸਟਰੀਸ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ ਹੁਣ ਜਿਹੜੇ ਅੱਜ ਕੱਲ੍ਹ ਸਾਇੰਸ ਪਾਰਕਸ ਬਣ ਰਹੇ ਨੇ ਸਾਇੰਸ ਸਿਟੀ ਬਣੀ ਹੈ ਕਪੂਰਥਲਾ ਜਲੰਧਰ ਰੋਡ 'ਤੇ ਇਸ ਤਰੀਕੇ ਲੁਧਿਆਣਾ ਦੇ ਕੋਲ ਕਈ ਇੰਡਸਟਰੀਅਲ ਪਾਕਸ ਬਣੇ ਨੇ ਇਹ ਸਾਰੇ ਥੀਮ ਦੇ ਉੱਪਰ ਨੇ ਜਿਨ੍ਹਾਂ ਦਾ ਸਾਰੇ ਪੰਜਾਬ ਵਾਸੀਆਂ ਨੂੰ ਵੀ ਅਤੇ ਭਾਰਤ ਵਾਸੀਆਂ ਨੂੰ ਵੀ ਮਾਣ ਹੈ